ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਅ ਤੁਸੀਂ ਯੂਨੀਕ ਫੋਟੋਗ੍ਰਾਫਰ ਬਰਨਾਲਾ ਤੋਂ ਬੋਲਦੇ ਜੀ ਹਾਂਜੀ ਮੈਂ ਨਾ ਤੁਹਾਡਾ ਨਾ ਮੈਂ ਐਤੋ ਕੋ ਨਸਪਿੰਡ ਤੋਂ ਬੋਲ ਰਿਹਾ ਜੀ ਅਸੀਂ ਨਾ ਤੁਹਾਡਾ ਇੰਸਟਾਗ੍ਰਾਮ ਦੇ ਉੱਤੇ ਪੇਜ ਵੇਖਿਆ ਸੀਗਾ ਤੁਹਾਡਾ ਕੰਮ ਵੇਖਿਆ ਸੀਗਾ ਅਤੇ ਸਾਡ ਹਾਂ ਆਪਣੇ ਨਾ ਮੈਰਿਜ ਦਾ ਪ੍ਰੋਗਰਾਮ ਹੈ ਜੀ ਅਕਤੂਬਰ ਦੇ ਵਿੱਚ ਹਾਂਜੀ ਉਹਦੇ ਰਿਗਾਰਡਿੰਗ ਗੱਲ ਹਾਂ ਅ ਆਪਾਂ ਉਹ ਕਰਨੀ ਸੀ ਤੁਹਾਡੇ ਤੋਂ ਥੋੜ੍ਹੀ ਜਿਹੀ ਕੰਸਲਟੇਸ਼ਨ ਕਰਨੀ ਸੀਗੀ ਅਸੀਂ ਤਾਂ ਪ੍ਰੀ ਵੈਡਿੰਗ ਦਾ ਸੋਚ ਰਹੇ ਸੀਗੇ ਹਾਂ ਹਾਂਜੀ ਮੇਰੇ ਨਾ ਮਾਮਾ ਜੀ ਦੇ ਬੇਟੇ ਦੀ ਮੈਰਿਜ ਹੈਗੀ ਉਹ ਰਿਸ਼ਤਾ ਅਸੀਂ ਕਰਾਇਆ ਕਰਦੇ ਤੇ ਉਹਦੇ ਕਰਕੇ ਨਾ ਫਿਰ ਮੈਂ ਇਹ ਸਾਰਾ ਕੁਛ ਮੈਂ ਹੀ ਦੇਖਣਾ ਗਾ ਇਸ ਲਈ ਮੈਂ ਪੁੱਛਦਾ ਇੱਕ ਤਾਂ ਪ੍ਰੀ ਵੈਡਿੰਗ ਦਾ ਵੇ ਪੁੱਛਣਾ ਤੁਹਾਡੇ ਕੋਲੋਂ ਵੀ ਕੋਈ ਲੋਕੇਸ਼ਨ ਕਿੱਥੋਂ ਦੀ ਤੁਸੀਂ ਰਿਕੇਮੈ ਲ ਕਰੋਗੇ ਜਾਂ ਕੀ ਤੁਹਾਡੇ ਚਾਰਜਿਸ ਹੋਣਗੇ ਮੈਨੂੰ ਥੋੜ੍ਹਾ ਜਿਹਾ ਦੱਸੋ ਮਾੜਾ ਜਿਹਾ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਇੱਕ ਨਾ ਤੁਸੀਂ ਤੁਹਾਡੇ ਮੈਂ ਉਹਦੀ ਇੰਸਟਾਗ੍ਰਾਮ ਤੇ ਦੇਖਿਆ ਇੱਕ ਨਾ ਖੂਹ ਵਗੈਰਾ ਹੈਗਾ ਉੱਥੋਂ ਪਾਣੀ ਕੱਡ ਕੱਢਦੀ ਸੀ ਇੱਕ ਲੜਕੀ ਜਾਂ ਕੁਛ ਛੱਪੜ ਜਿਹਾ ਬਣਿਆ ਹੋਇਆ ਕਾਨਿਆਂ ਦਾ ਉਹ ਸਾਰਾ ਕੁਛ ਹੈਗਾ ਬਰਨਾਲੇ ਆਪਣੇ ਕੋਲ ਹਾਂਜੀ ਉਹ ਹਾਂਜੀ ਹਾਂਜੀ ਉਹ ਅਸੀਂ ਨਾ ਫਿਰ ਸਾਰੀ ਫੈਮਿਲੀ ਬਹਿ ਕੇ ਦੇਖਿਆ ਉਹ ਵਾਲਾ ਦਾ ਨਾ ਸਾਨੂੰ ਬਹੁਤ ਅੱਛਾ ਲੱਗਾ ਵੀ ਤਾਂਹੀਓ ਅਸੀਂ ਦੇਖੇ ਤਾਂ ਹੋਰ ਵੀ ਆ ਤਾਂਈਓ ਅਸੀਂ ਤੁਹਾਡੇ ਨਾਲ ਪਹਿਲੇ ਹੀ ਚੋਆਇਸ ਅਸੀਂ ਤੁਹਾਨੂੰ ਚੁਣਿਆ ਵੀ ਤੁਹਾਡੇ ਨਾਲ ਗੱਲ ਕਰੀ ਤੁਹਾਡਾ ਕੰਮ ਅਸੀਂ ਵੇਖਿਆ ਹੈਗਾ ਆਨਲਾਈਨ ਅਸੀਂ ਕਿਹਾ ਵੀ ਚਲੋ ਗੱਲ ਕਰ ਲਈਏ ਹਾਂਜੀ ਬਾਈ ਅੱਛਾ ਜੀ ਅੱਛਾ ਜੀ ਸਾਰਾ ਟਰਡੀਸ਼ਨਲ ਹੈ ਸਮਝ ਲਓ ਤੁਹਾਡੇ ਕੋਲ ਬਹੁਤ ਵਧੀਆ ਅੱਛਾ ਹਾਂਜੀ ਬਸ ਹਾਂਜੀ ਹਾਂਜੀ ਬਿਲਕੁਲ ਅਸੀਂ ਵੀ ਇਹੀ ਲੱਭ ਰਹੇ ਸੀਗੇ ਜੀ ਹਾਂ ਸਾਡਾ ਹੈਗਾ ਗਾ ਜੀ ਅਠਾਰਾਂ ਅਕਤੂਬਰ ਦਾ ਹੈਗਾ ਜੀ ਵਿਆਹ ਤਾਂ ਹਾਂਜੀ ਅਤੇ ਪ੍ਰੀ ਵੈਟਿੰਗ ਤੁਸੀਂ ਆਪਣੀ ਕੋਈ ਪਹਿਲਾਂ ਦੇਖ ਲਓ ਉਦੋਂ ਠੀਕ ਹੈ ਜੀ ਨਹੀਂ ਨਹੀਂ ਚੌਦਾਂ ਰੱਖ ਲੈਂਦੇ ਹਾਂ ਜੀ ਆਪਾਂ ਸੋਲਾਂ ਤਾਂ ਫਿਰ ਵਾਹਲੀ ਨੇੜੇ ਆਜੂ ਹੋਰ ਤਿਆਰੀਆਂ ਵੀ ਹਾ ਅਤੇ ਇੱਕ ਅ ਫ਼ੀਸ ਵਗੈਰਾ ਮੈਨੂੰ ਦੱਸ ਦਿਓ ਜੀ ਫਿਰ ਮੈਂ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਅੱਛਾ ਅੱਛਾ ਜੀ ਠੀਕ ਹੈ ਜੀ ਹਾਂ ਇੱਕ ਉਹ ਹੋਇਆ ਗਿਫਟ ਦੇ ਵਜੋਂ ਵੱਡੀਆਂ ਵੱਡੀਆਂ ਫੋਟੋਆਂ ਜਿਹੀਆਂ ਬਣਾ ਕੇ ਦਿੰਦੇ ਆ ਦੋ ਤਿੰਨ ਅਤੇ ਨਾਲ ਉਹ ਕੱਪ ਕੁੱਪ ਜਿਹੇ ਅ ਕਪਲ ਕੱਪ ਜਿਹੇ ਉਹ ਸਾ

ਅੱਛਾ ਠੀਕ ਹੈ ਅੱਛਾ ਠੀਕ ਠੀਕ ਹੈ ਜੀ ਚਲੋ ਥੈਂਕ ਹਾਂਜੀ ਹਾਂਜੀ ਮੈਂ ਹਾਂ ਕੱਲ੍ਹ ਆਉਣਾ ਵੀਰ ਜੀ ਮੈਂ ਠੀਕ ਹੈ ਜੀ ਹਾਂਜੀ ਹਾਂਜੀ ਜ਼ਰੂਰ ਜੀ ਓਕੇ ਥੈਂਕ ਯੂ ਵੀਰੇ